ਮੇਰਾ ਜੋ ਪਸੰਦੀਦਾ ਮਾਰਸ਼ਲ ਆਰਟ ਉਹ ਗੱਤਕਾ ਹੈ ਅਤੇ ਇਸ ਪਸੰਦੀਦਾ ਮਾਰਸ਼ਲ ਆਰਟ ਦੇ ਵਿੱਚ ਜਿਹੜਾ ਹੈ ਸਾਡਾ ਸਾਡਾ ਉਸਤਾਦ ਜਿਹੜਾ ਹੈ ਮਨਿੰਦਰ ਸਿੰਘ ਉਹ ਮੇਰਾ ਜਿਹੜਾ ਹੈ ਫੇਵਰਟ ਜਿਹੜਾ ਹੈ ਜਾਂ ਮਾਰਸ਼ਲ ਆਰਟਿਸਟ ਹੈ ਕਿਉਂਕਿ ਉਸਨੇ ਜਿਹੜਾ ਹੈ ਸਾਨੂੰ ਇਸ ਆਰਟਿਸਟ ਜਿਹੜੀ ਹੈਗੀ ਆਪਣੀ ਆਰਟ ਹੈ ਮਾਰਸ਼ਲ ਆਰਟ ਇਹਦੇ ਨਜ਼ਦੀਕ ਇਹਦੇ ਨਾਲ ਜੋੜਿਆ ਉਸ ਗੱਲ ਕਰਕੇ ਵੀ ਜਿਹੜੇ ਇਹ ਮੈਨੂੰ ਚੰਗਾ ਲੱਗਦਾ ਹੈ ਇੱਕ ਮਨਪਸੰਦ ਦਾ ਮੇਰਾ ਆਰਟਿਸਟ ਦੇ ਵਿੱਚੋਂ ਉਹਨੂੰ ਮੈਂ ਮੰਨਦਾ ਹੈਗਾ ਇਕੱਲਾ ਆਰਟ ਜਾਂ ਮਾਰਸ਼ਲ ਆਰਟ ਨਾਲ ਨਹੀਂ ਜੋੜਿਆ ਉਹਨੇ ਸਾਨੂੰ ਸਿੱਖੀ ਸਰੂਪ ਨਾਲ ਵੀ ਜੋੜਿਆ ਸਾਡੇ ਕਲਚਰ ਸਾਡੇ ਵਿਰਸੇ ਨਾਲ ਵੀ ਜੋੜਿਆ ਹੈਗਾ ਤਾਂ ਉਸ ਪੁਆਇੰਟ ਤੋਂ ਵੀ ਕਿਉਂਕਿ ਉਹ ਜਿਹੜਾ ਹੈ ਇਨਸਾਨ ਆ ਜੋ ਆਰਟਿਸਟ ਹੈ ਉਹ ਸਿਰਫ ਬਾਹਰੀ ਪੁਆਇੰਟ ਤੋਂ ਹੀ ਜਾਂ ਬਾਹਰੀ ਦਿਖਾਵੇ ਤੋਂ ਹੀ ਆਰਟਿਸਟ ਨਹੀਂ ਅੰਦਰੋਂ ਵੀ ਓਨਾ ਹੀ ਹੈ ਜਿਹੋ ਜਿਹਾ ਬਾਹਰੋਂ ਹੈ ਤਾਂ ਉਸ ਕਾਰਨ ਕਰਕੇ ਵੀ ਜਿਹੜਾ ਹੈ ਮੈਨੂੰ ਉਹ ਆਰਟਿਸਟ ਜਿਹੜਾ ਹੈ ਮਾਰਸ਼ਲ ਆਰਟ ਦਾ ਗੱਤਕੇ ਦਾ ਜਿਹੜਾ ਹੈ ਇੱਕ ਮੇਰਾ ਪਸੰਦੀਦਾ ਮਾਰਸ਼ਲ ਆਰਟਿਸਟ ਹੈ